ਅੱਜ ਕੱਲ੍ਹ ਦੀ ਜ਼ਿੰਦਗੀ ਵਿੱਚ ਆਪਾਂ ਕਾਫੀ ਜ਼ਿਆਦਾ ਉਪਕਰਨ ਵਰਤਦੇ ਅਨ ਸਾਰੀ ਉਪਕਰਨ ਜਿਵੇਂ ਟੈਕ ਨਵੀਂ ਟੈਕਨੋਲਜੀ ਨਾਲ ਸੰਬੰਧਿਤ ਹਨ ਅਤੇ ਜਿਵੇਂ ਅੱਜ ਅੱਜ ਕੱਲ੍ਹ ਸਾਰੇ ਕੰਮ ਹੀ ਉਪਕਰਨਾਂ ਆਪਣੇ ਨਵੇਂ ਟੈਕਨੋਲਜੀ ਸੰਬੰਧਿਤ ਉਪਕਰਨਾਂ ਨਾਲ ਹੀ ਹੋ ਰਹੇ ਨੇ ਅਤੇ ਜਿਵੇਂ ਮੈਂ ਫੋਨ ਆਪਾਂ ਫੋਨ ਵਰਤਦੇ ਹਾਂ ਲੈਪਟੋਪ ਵਰਤਦੇ ਹਾਂ ਅਤੇ ਆਪਣੇ ਟੈਬਲੇਟ ਵਰਤਦੇ ਹਾਂ ਮਤਲਬ ਇਹ ਸਾਡੀ ਡੇਲੀ ਦੀ ਦਿਨ ਚਰਿਆ ਵਿੱਚ ਸਾਰੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹੈ ਅਤੇ ਫੋਨ ਤਾਂ ਸਾਡੀ ਜ਼ਿੰਦਗੀ ਦਾ ਇੱਕ ਇੰਨਾਂ ਅਹਿਮ ਹਿੱਸਾ ਬਣ ਚੁੱਕਿਆ ਹੈ ਆਪਾਂ ਕੋਈ ਵੀ ਕੰਮ ਕਰਨਾ ਹੈ ਅਤੇ ਜਿਹੜਾ ਅੱਗੇ ਘੰਟਿਆਂ ਦਾ ਕੰਮ ਹੁੰਦਾ ਸੀ ਅੱਜ ਕੱਲ੍ਹ ਫੋਨ 'ਤੇ ਮਿੰਟਾਂ ਵਿੱਚ ਹੋ ਜਾਂਦਾ ਗਾ ਕਿਸੇ ਨੂੰ ਕੋਈ ਸੰਦੇਸ਼ ਪੁਜਾਣਾ ਕੁਛ ਵੀ ਕੋਈ ਅੱਜ ਕੱਲ੍ਹ ਤਾਂ ਪੈਸੇ ਵੀ ਕ ਲੈਣੇ ਅਤੇ ਪੈਸੇ ਕਿਸੇ ਨੂੰ ਭੇਜਣੇ ਸਾਰਾ ਕੁਛ ਫੋਨ ਦੇ ਰਾਹੀਂ ਹੋਈ ਜਾਂਦਾ ਅਤੇ ਇਹਦਾ ਸਾਡੀ ਜ਼ਿੰਦਗੀ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਅਤੇ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਇਨ੍ਹਾਂ ਚੀਜ਼ਾਂ ਨੇ ਇਹ ਫੋਨਾਂ ਨੇ ਅਤੇ ਨਵੀਂ ਟੈਕਨੋਲਜੀ ਨੇ ਸਾਰੀਆਂ ਚੀਜ਼ਾਂ ਨੇ ਸਾਡੀ ਬ ਕਿ ਸਾਡੇ ਜਿਹੜੇ ਘੰਟਿਆਂ ਵਾਲੇ ਕੰਮ ਸੀ ਉਹ ਮਿੰਟਾਂ ਵਿੱਚ ਲਿਆ ਤੇ ਮਿੰਟਾਂ ਵਾਲੇ ਕੰਮ ਸੈਕਿੰਡਾਂ ਵਿੱਚ ਲਿਆ ਤੇ ਸਾਡੇ ਲੈਪਟੋਪਾਂ ਨੇ ਸਾਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਗੀਆਂ ਇਨ੍ਹਾਂ ਚੀਜ਼ਾਂ ਨੇ ਅਤੇ ਅਗਰ ਇਹ ਚੀਜਾਂ ਸਾਡੀ ਜ਼ਿੰਦਗੀ 'ਚ ਨਾ ਹੋਣ ਜਾਂ ਨਾ ਹੁੰਦੀਆਂ ਤਾਂ ਸਾਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਅਤੇ ਕਾਫ਼ੀ ਤਾਂ ਕੰਮ ਇੱਦਾਂ ਦੇ ਸੀਗੇ ਜਿਹੜੇ ਖੜ੍ਹੇ ਜਾਣੇ ਸੀਗੇ ਅਤੇ ਫੇਰ ਸਾਡਾ ਟਾਈਮ ਬਹੁਤ ਜ਼ਿਆਦਾ ਬਰਬਾਦ ਹੋਣਾ ਸੀ ਇਨ੍ਹਾਂ ਚੀਜ਼ਾਂ ਵਿੱਚ ਕਿ ਆਪਾਂ ਬਹੁਤ ਜ਼ਿਆਦਾ ਟਾਈਮ ਬਰਬਾਦ ਕਰਨਾ ਸੀਗਾ ਕਿ ਕਿਸੇ ਨੂੰ ਜਾ ਕੇ ਦੱਸਣਾ ਕੋਈ ਗੱਲ ਅੱਜ ਕੱਲ੍ਹ ਫੋਨ 'ਤੇ ਹੀ ਸਾਰਾ ਕੁਛ ਆ ਜਾਂਦਾ ਪੈਸੇ ਭੇਜ ਹੋ ਜਾਂਦੇ ਪੈਸੇ ਲੈ ਹੋ ਜਾਂਦੇ ਸਾਰਾ ਕੁਛ ਫੋਨ 'ਤੇ ਆਪਾਂ ਕਰਦੇ ਰਹਿੰਦੇ ਹਾਂ